ਹਾਂਜੀ ਬਾਗਬਾਨੀ ਜਿਹੜੀ ਬਣਾਈ ਹੋਈ ਹੈ ਮੈਂ ਮੈਨੂੰ ਸ਼ੌਂਕ ਆ ਆਪਣੇ ਫੁੱਲ ਪੌਦੇ ਸਬਜ਼ੀਆਂ ਵਗੈਰਾ ਸਾਰਾ ਕੁਛ ਬੀਜਣ ਦਾ ਜਿੱਦਾਂ ਹੁਣ ਹਵੇਲੀ ਸਾਡੀ ਲਾਗੇ ਉਹਦੇ ਵਿੱਚ ਅਸੀਂ ਸਬਜ਼ੀਆਂ ਬੀਜੀਆਂ ਨੇ ਫ਼ਲਾਂ ਦੇ ਬੂਟੇ ਲਾਏ ਹੋਏ ਨੇ ਜਿੱਦਾਂ ਨਿੰਬੂ ਦਾ ਲਾਇਆ ਹੋਇਆ ਸੰਤਰੇ ਲਾਏ ਹੋਏ ਨੇ ਉੱਥੇ ਅਮਰੂਦ ਲਾਏ ਹੋਏ ਨੇ ਆਪਣੀ ਛੋਟੀ ਜਿਹੀ ਉੱਥੇ ਵੀ ਹਵੇਲੀ ਵਿੱਚ ਸਾਰਾ ਕੁਝ ਬਣਾਇਆ ਹੋਇਆ ਫ਼ਲਾਂ ਦੇ ਅਤੇ ਸਬਜ਼ੀਆਂ ਦੇ ਫਿਰ ਅਸੀਂ ਵਿਹੜੇ ਵਿੱਚ ਵੀ ਇੱਕ ਛੋਟੀ ਜਿਹੀ ਬਗੀਚੀ ਬਣਾਈ ਹੋਈ ਹੈ ਬੜੀ ਸੋਹਣੀ ਉਹਦੇ ਵਿੱਚ ਸੋਹਣੇ ਸੋਹਣੇ ਫੁੱਲ ਲਾਏ ਹੋਏ ਨੇ ਘਾਹ ਲਾਇਆ ਹੋਇਆ ਹੈ ਛੱਤ ਦੀ ਉੱਪਰ ਵੀ ਗਮਲੇ ਰੱਖੇ ਨੇ ਉਨ੍ਹਾਂ ਵਿੱਚ ਵੀ ਬੂਟੇ ਲਾਏ ਨੇ ਫੁੱਲ ਪੌਦੇ ਬਹੁਤ ਸੋਹਣੇ ਲਾਏ ਨੇ ਜਿਸ ਤਰ੍ਹਾਂ ਫੁੱਲ ਤਰਾਂ ਤਰਾਂ ਦੇ ਰੰਗਦਾਰ ਮੇਰੇ ਘਰ ਨੂੰ ਵੀ ਬਹੁਤ ਸੋਹਣਾ ਬਣਾਉਂਦੀ ਜਿਹੜੀ ਛੋਟੀ ਜਿਹੀ ਬਗੀਚੀ ਸਾਡੀ ਵਿਹੜੇ ਵਿੱਚ ਬਣੀ ਹੋਈ ਆ ਉਹਨੂੰ ਸਵੇਰੇ ਸ਼ਾਮ ਵੇਖਣਾ ਸਵੇਰੇ ਵੀ ਪਾਣੀ ਦਿਓ ਸ਼ਾਮ ਨੂੰ ਦਿਓ ਸੋਹਣਾ ਲੱਗਦਾ ਅਤੇ ਬੱਚੇ ਵੀ ਖੇਡਦੇ ਨੇ ਹਰੇਕ ਵਾਰੀ ਬਗੀਚੀ ਬਹੁਤ ਸੋਹਣੀ ਬਣੀ ਹੋਈ ਆ ਉਹਦੇ ਵਿੱਚ ਜਿਸ ਤਰ੍ਹਾਂ ਗੁਟੇ ਦੇ ਫੁੱਲ ਆ ਗੁਲਾਬ ਦੇ ਫੁੱਲ ਆ ਉਹ ਵੀ ਲਾਏ ਹੋਏ ਆ ਮੈਂ ਮੈਨੂੰ ਸ਼ੌਂਕ ਆ ਵੀ ਮੈਂ ਆਪਣੇ ਘਰ ਵਿੱਚ ਛੋਟੀ ਜਿਹੀ ਬਗੀਚੀ ਬਣਾਵਾਂ ਸੋਹਣਾ ਲੱਗੇ ਮੈਂ ਫਿਰ ਉਹਨੂੰ ਬਣਾਇਆ ਤਿਆਰ ਕੀਤਾ ਅਤੇ ਉਹਦੇ ਵਿੱਚ ਬੱਚੇ ਵੀ ਸ਼ਾਮ ਨੂੰ ਖੇਡ ਦੇ ਜਿਸ ਤਰ੍ਹਾਂ ਆਪਾਂ ਵੀ ਖੇਡਦੇ ਸਾਰੇ ਰਲ ਮਿਲ ਕੇ ਬਹਿੰਦੇ ਉਹ ਸੋਹਣੀ ਹਰੀ ਭਰੀ ਠੰਡੀ ਹਵਾ ਆਉਂਦੀ ਸੋਹਣਾ ਲੱਗਦਾ ਹੈ ਜਦੋਂ ਉੱਥੇ ਬੈਠੇ ਹੋਈਏ ਬਹੁਤ ਸੋਹਣੀ ਬਣੀ ਹੋਈ ਹੈ ਬਗੀਚੀ ਸਾਡੀ ਛੋਟੀ ਜਿਹੀ ਫੁੱਲਾਂ ਨਾਲ ਹਰੀ ਭਰੀ